ਜੇ ਅਸੀਂ ਭੰਗੜੇ ਦੀ ਮਹੱਤਤਾ ਬਾਰੇ ਗੱਲ ਕਰੀਏ ਤਾਂ ਅਸੀਂ ਭੰਗੜੇ ਨੂੰ ਅਸੀਂ ਦੇ ਆਪਣੇ ਜ਼ਰੀਏ ਨਾਲ ਦੇਖੀਏ ਤਾਂ ਭੰਗੜਾ ਅੱਜ ਦੇ ਸਮੇਂ ਵਿੱਚ ਬਹੁਤ ਮਸ਼ਹੂਰ ਹੈ ਭੰਗੜਾ ਪੰਜਾਬ ਦਾ ਹੀ ਨਹੀਂ ਲੋਗੋ ਦੇਸ਼ ਪ੍ਰਦੇਸ਼ ਵਿੱਚ ਬਹੁਤ ਜ਼ਿਆਦਾ ਵਿਕਾਸ ਕਰ ਗਿਆ ਹੈ ਭੰਗੜਾ ਸਾਡੇ ਪੰਜਾਬ ਦਾ ਇੱਕ ਲੋਕ ਨਾਚ ਹੈ ਜੋ ਕਿ ਹਰ ਇੱਕ ਪੰਜਾਬੀ ਲਈ ਉਸ ਨੂੰ ਹਾਵ ਭਾਵ ਨੂੰ ਪ੍ਰਗਟ ਕਰਦਾ ਹੈ ਪੰਜਾਬੀ ਜਦੋਂ ਵੀ ਖੁਸ਼ ਹੁੰਦੇ ਹਨ ਤਾਂ ਉਹ ਭੰਗੜਾ ਪਾ ਕੇ ਆਪਣੀ ਸਾਰੀ ਖੁਸ਼ੀ ਬਿਆਨ ਕਰਦੇ ਹਨ ਭੰਗੜੇ ਨੂੰ ਅਸੀਂ ਜ਼ਿਆਦਾਤਰ ਵਿਆਹਾਂ ਸ਼ਾਦੀਆਂ ਅਤੇ ਕੰਪੀਟੀਸ਼ਨ ਚੀਜ਼ਾਂ ਵਿੱਚ ਦੇਖਣ ਨੂੰ ਮਿਲਦਾ ਹੈ ਭੰਗੜਾ ਇੱਕ ਅਜਿਹੀ ਚੀਜ਼ ਹੈ ਜੋ ਸਾਡੇ ਸਰੀ ਸਰੀਰ ਨੂੰ ਰਿਸ਼ਟ ਕਰਦੀ ਹੈ ਇਹ ਇੱਕ ਤਰ੍ਹਾਂ ਦੀ ਐਕਸਾਈਜ਼ ਵੀ ਹੈ ਭੰਗੜੇ ਨਾਲ ਲੋਕ ਕੁਛ ਖੁਸ਼ੀ ਹੋ ਕੇ ਨੱਚਦੇ ਹਨ ਭੰਗੜਾ ਇਸ ਤਰ੍ਹਾਂ ਨੱਚਦੇ ਹਨ ਕਿ ਸਾਰੇ ਖੁਸ਼ੀ ਲਾਲ ਲਾਹ ਦਿੰਦੇ ਹਨ ਭੰਗੜਾ ਇੱਕ ਬਹੁਤ ਜ਼ਿਆਦਾ ਵਧੀਆ ਲੋਕ ਨਾਚ ਹੈ ਭੰਗੜੇ ਤੋਂ ਇਲਾਵਾ ਭੰਗੜੇ ਦਾ ਪ੍ਰਸਿੱਧ ਦੇਸ਼ਾਂ ਵਿੱਚ ਜਿਵੇਂ ਕਨੇਡਾ ਅੱਜ ਕਨੇਡਾ ਵਿੱਚ ਬਹੁਤ ਜ਼ਿਆਦਾ ਪ੍ਰਚਲਿਤ ਹੈ ਕਿਉਂਕਿ ਕੈਨੇਡਾ ਦੇ ਜ਼ਿਆਦਾਤਰ ਲੋਕ ਪੰਜਾਬ ਰਹਿੰਦੇ ਹਨ ਜੋ ਕਿ ਜੋ ਕਿ ਭੰਗੜਾ ਪਾਉਂਦੇ ਹਨ ਭੰਗੜੇ ਨੂੰ ਅਸੀਂ ਦੂਜਾ ਦੂਜਾ ਖੇਤਰ ਵੀ ਕਹਿੰਦੇ ਹਨ ਭੰਗੜੇ ਵਿੱਚ ਲੋਕ ਮੁਕਾਬਲੇ ਕਰਵਾਉਂਦੇ ਹਨ ਜਿਸ ਦੇ ਪ੍ਰਾਈਸ ਜਿੱਤਦੇ ਹਨ ਅਤੇ ਆਪਣੀ ਮਹਾਨਤਾ ਮਹਿਸੂਸ ਕਰਦੇ ਹਨ ਭੰਗੜਾ ਅੱਜ ਦੇ ਸਮੇਂ ਵਿੱਚ ਬਹੁਤ ਜ਼ਿਆਦਾ ਮਸ਼ਹੂਰ ਹੈ ਭੰਗੜੇ ਦੇ ਵਿੱਚ ਇੱਕ ਕੁੜਤਾ ਪਜਾਮਾ ਅਤੇ ਪੱਗ ਅਤੇ ਜੁੱਤੀ ਅਤੇ ਸੋਟੀ ਹੁੰਦੀ ਹੈ ਜੋ ਕਿ ਭੰਗੜਾ ਪਾਉਂਦੇ ਵਕਤ ਸਾਰੇ ਦੱਸਦੇ ਹਨ ਅਤੇ ਸਟੈਪ ਬਾਏ ਸਟੈਪ ਭੰਗੜਾ ਕਰਦੇ ਹਨ ਮੁਕਾਬਲਿਆਂ ਵਿੱਚ ਇਸ ਦੀ ਬਹੁਤ ਜ਼ਿਆਦਾ ਵੱਡੇ ਪੱਧਰ 'ਤੇ ਭੰਗੜਾ ਪਾਉਂਦੇ ਹਨ ਪੱਧਰ ਦੇ ਪ੍ਰਾਈਜ਼ ਵੀ ਹੁੰਦੇ ਹਨ ਰਾਸ਼ਟਰੀ ਲੈਵਲ ਤੱਕ ਵੀ ਭੰਗੜਾ ਪਾਇਆ ਜਾਂਦਾ ਹੈ ਜੋ ਅੰਤਰਰਾਸ਼ਟਰੀ ਲੈਵਲ ਤੱਕ ਵੀ ਪਾਇਆ ਜਾਂਦਾ ਹੈ ਭੰਗੜਾ ਪੰਜਾਬ ਵਿੱਚ ਬਹੁਤ ਜ਼ਿਆਦਾ ਪ੍ਰਚਲਿਤ ਹੈ ਭੰਗੜੇ ਨੂੰ ਅਸੀਂ ਬਹੁਤ ਜ਼ਿਆਦਾ ਦੇਖਣਾ ਪਸੰਦ ਕਰਦੇ ਹਨ ਅਖੀਰ ਹਿੱਸਾ ਹੀ ਭੰਗੜਾ ਹੁੰਦਾ ਹੈ ਕੋਈ ਵੀ ਕਾਲਜ ਯੂਥ ਫੈਸਟੀਵਲ ਵਿੱਚ ਹਰੇਕ ਬੱਚਾ ਭੰਗੜੇ ਨੂੰ ਦੇਖਣ ਲਈ ਉਤਸ਼ਾਹਿਤ ਹੁੰਦਾ ਹੈ ਭੰਗੜੇ ਵਿੱਚ ਅਸੀਂ ਬਹੁਤ ਜ਼ਿਆਦਾ ਹਾਵ ਭਾਵ ਮਹਿਸੂਸ ਕਰਦੇ ਹਾਂ ਭੰਗੜਾ ਸਾਡੀ ਰੂਹ ਰੂਹ ਵਿੱਚ ਭਰ ਭਰਿਆ ਹੋਇਆ ਹੈ ਭੰਗੜਾ ਬਹੁਤ ਜ਼ਿਆਦਾ ਵਧੀਆ ਹੈ